ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਰੀਤੀ ਰਿਵਾਜਾਂ ਅਤੇ ਵਿਰਸਿਆਂ ਦੇ ਲੋਕਾਂ ਦੇ ਕਿੱਤੇ ਅਤੇ ਕਾਰੋਬਾਰਾਂ ਨੂੰ ਅਗਰ ਇਕੱਠੇ ਮਿਲਾਈਏ ਤਾਂ ਅਸੀਂ ਭਾਈਚਾਰਾ ਵੀ ਬਣਾ ਸਕਦੇ ਹਾਂ ਅਤੇ ਆਰਥਿਕਤਾ ਦਾ ਸਮਰਥਨ ਵੀ ਕਰ ਸਕਦੇ ਹਾਂ